ਵੈਸੇ ਤਾਂ ਮੈਂ ਕਿਸੇ ਸੰਗੀਤ ਉਤਸਵ ਜਾਂ ਵੱਡੇ ਸਮਾਗਮ ਵਿੱਚ ਜਾਣਾ ਪਸੰਦ ਨਹੀਂ ਕਰਦੀ ਪਰ ਆਪਣੇ ਸਕੂਲ ਟਾਈਮ ਵਿੱਚ ਮੈਂ ਆਪਣੇ ਸਕੂਲ ਫਰੈਂਡਾਂ ਨਾਲ ਚੰਡੀਗੜ੍ਹ ਟੈਗੋਰ ਸੈਟਰ ਜਿੱਥੇ ਰਿਚਾ ਸ਼ਰਮਾ ਦਾ ਕੌਂਨਸਟ ਸੀ ਉੱਥੇ ਗਈ ਸੀ ਉਹ ਕੌਂਨਸਟ ਮੇਰੀ ਲਾਈਫ ਦਾ ਬੈਸਟ ਕੌਨਸਟ ਸੀ ਕਿਉਂਕਿ ਉਸ ਟਾਈਮ ਮੈਂ ਆਪਣੇ ਫਰੈਂਡਾਂ ਨਾਲ ਉਹ ਕੌਂਨਸਟ ਦੇਖਣ ਲਈ ਗਈ ਸੀ ਉਹ ਕੌਂਨਸਟ ਬਹੁਤ ਹੀ ਚੰਗਾ ਸੀ ਉੱਥੇ ਬਹੁਤ ਸਾਰੇ ਸਟੂਡੈਂਟ ਆਏ ਸੀ ਹਰ ਹਰ ਸਕੂਲ ਦੇ ਸਟੂਡੈਂਟਸ ਆਏ ਸੀ ਜਦ ਰਿਚਾ ਸ਼ਰਮਾ ਨੇ ਐਂਟਰੀ ਕੀਤੀ ਸੀ ਉਸ ਦਾ ਸਵਾਗਤ ਇੰਨੀਆਂ ਤਾਲੀਆਂ ਨਾਲ ਹੋਇਆ ਸੀ ਕਿ ਪੂਰਾ ਸਟੇਡੀਅਮ ਤਾਲੀਆਂ ਦੀ ਗੂੰਜ ਨਾਲ ਗੂੰਜ ਰਿਹਾ ਸੀ ਰਿਚਾ ਸ਼ਰਮਾ ਜੋ ਕਿ ਇੱਕ ਮਸ਼ਹੂਰ ਗਾਇਕਾ ਹੈ ਉਹ ਬਹੁਤ ਹੀ ਚੰਗੀ ਗਾਇਕਾ ਹੈ ਉਸ ਦੀ ਗਾਇਕੀ ਸੁਣ ਕੇ ਉਹਦੇ ਸਟੇਡੀਅਮ ਵਿੱਚ ਤਾਲੀਆਂ ਵੱਜਣ ਲੱਗੀ ਸੀ ਇਹ ਕੌਂਨਸਟ ਬਹੁਤ ਹੀ ਚੰਗਾ ਸੀ ਅਤੇ ਇਹ ਮੇਰੀ ਲਾਈਫ ਦਾ ਬੈਸਟ ਕੌਂਨਸਟ ਸੀ